ਪੇੜ ਪੌਦਿਆਂ ਦੀ ਸੰਭਾਲ ਦੇ ਤਰੀਕੇ ਮੌਸਮ ਦੇ ਨਾਲ ਬਦਲਦੇ ਰਹਿੰਦੇ ਹਨ ਗਰਮੀਆਂ ਦੇ ਵਿੱਚ ਹੋਰ ਤਰੀਕੇ ਵਰਤੇ ਜਾਂਦੇ ਹਨ ਅਤੇ ਸਰਦੀਆਂ ਦੇ ਵਿੱਚ ਕੁਛ ਹੋਰ ਹੀ ਤਰੀਕੇ ਵਰਤੇ ਜਾਂਦੇ ਹਨ ਸਰਦੀਆਂ ਦੇ ਵਿੱਚ ਆਪਣੇ ਪੇੜ ਪੌਦਿਆਂ ਨੂੰ ਬਚਾਉਣ ਦੇ ਲਈ ਮੈਂ ਉਹਨਾਂ ਨੂੰ ਪਾਣੀ ਘੱਟ ਤੋਂ ਘੱਟ ਲਗਾਉਂਦਾ ਹਾਂ ਜਿਸ ਨਾਲ ਉਹ ਠੰਡ ਤੋਂ ਬਚੇ ਰਹਿਣ ਦੂਸਰਾ ਮੈਂ ਕੀ ਕਰਦਾ ਹਾਂ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਦੇ ਉੱਪਰ ਕੋਈ ਚਾਦਰ ਜਾਂ ਕੋਈ ਚੀਜ਼ ਨਾਲ ਉਹਨਾਂ ਨੂੰ ਛਾਂ ਕਰਦਾ ਰਹਾਂ ਤਾਂ ਜੋ ਕਿ ਉਹ ਸੁਬਹਾ ਅਤੇ ਰਾਤ ਦੇ ਕੋਹਰੇ ਤੋਂ ਬਚੇ ਰਹਿਣ ਤੀਸਰਾ ਜਦੋਂ ਸਰਦੀਆਂ ਦੇ ਵਿੱਚ ਥੋੜ੍ਹੇ ਦਿਨ ਖੁੱਲ੍ਹ ਜਾਂਦੇ ਹਨ ਅਤੇ ਧੁੱਪਾਂ ਪੈਣ ਲੱਗ ਜਾਂਦੀਆਂ ਹਨ ਜਨਵਰੀ ਅਤੇ ਫਰਵਰੀ ਦੇ ਮਹੀਨੇ ਤਾਂ ਜੋ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲਵਾਉਂਦਾ ਹਾਂ ਤਾਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਸਰਦੀਆਂ ਦੇ ਪੇੜ ਅਤੇ ਪੌਦੇ ਉਸ ਜਗ੍ਹਾ ਬੀਜਾਂ ਜਿੱਥੇ ਪੂਰੀ ਧੁੱਪ ਪੈਂਦੀ ਹੋਵੇ ਤਾਂ ਜੋ ਪੂਰਾ ਸਾਲ ਇਹਨਾਂ ਪੇੜ ਪੌਦਿਆਂ ਨੂੰ ਕੋਈ ਵੀ ਦਿੱਕਤ ਨਾ ਆਵੇ ਇਹਨਾਂ ਦੇ ਫ਼ਲ ਇਹਨਾਂ ਦੀ ਪੈਦਾਵਾਰ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਅਤੇ ਤਾਂ ਅਤੇ ਇਹ ਬਿਮਾਰੀ ਤੋਂ ਵੀ ਬਚੇ ਰਹਿਣ